ਮੈਂ ਵੀਰੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਡਿਊਟੀ ਜਾਂਦਾ ਜੀ ਅਤੇ ਉੱਥੇ ਪਾਠ ਕਰੀਦਾ ਡਿਊਟੀ ਕਰੀਦੀ ਹੈ ਲਗਭਗ ਅੱਠ ਘੰਟੇ ਡਿਊਟੀ ਹੁੰਦੀ ਹੈ ਡਿਊਟੀ ਤੋਂ ਬਾਅਦ ਮੈਂ ਘਰ ਆ ਜਾਂਦਾ ਜੀ ਘਰ ਆ ਕੇ ਕੁਝ ਸਮਾਂ ਬੱਚਿਆਂ ਦੇ ਵਿੱਚ ਬਤੀਤ ਕਰੀਦਾ ਜਾਂ ਕੁਛ ਘੁੰਮ ਫਿਰ ਆਈਦਾ ਇੱਧਰ ਉੱਧਰ ਜਾ ਕੇ ਜਾਂ ਘਰ ਦੇ ਕੰਮ ਕਰ ਲਈ ਦੇ ਨੇ ਅਤੇ ਇਸ ਤਰ੍ਹਾਂ ਨਾ ਵਿਹਲਾ ਸਮਾਂ ਮੈਂ ਬਤੀਤ ਕਰ ਸ ਲੈਂਦਾ ਹੁੰਦਾ ਜੀ